ਇੱਕ ਚੰਗਾ ਕਲਾਕਾਰ ਹੈ ਜੋ ਉਹ ਹਮੇਸ਼ਾ ਸਿੱਖਦਾ ਰਹਿੰਦਾ ਹੈ ਤਾਂ ਹਮੇਸ਼ਾ ਆਪਣੇ ਅੰਦਰ ਸਿੱਖਣ ਦੀ ਜਿਹੜੀ ਭਾਵਨਾ ਹੈ ਉਹਨੂੰ ਕਦੇ ਵੀ ਖਤਮ ਨਹੀਂ ਹੋਣ ਦੇਣਾ ਚਾਹੀਦਾ ਜੇ ਤੁਸੀਂ ਸ ਕਹਾਉਣਾ ਚਾਹੁੰਦੇ ਹੋ ਕਿ ਵੀ ਅਸੀਂ ਚੰਗੇ ਚਿੱਤਰਕਾਰ ਹਾਂ ਤਾਂ ਜਿਹੜੀ ਆਪਣੀ ਸਮੇਂ ਦੇ ਨਾਲ ਹਰ ਤਰੀਕੇ ਦੀ ਕਲਾ ਨੂੰ ਕਲਾ ਦੀ ਅਹਿਮੀਅਤ ਨੂੰ ਸਮਝੋ ਅਤੇ ਉਹ ਉਹਦੀ ਇੱਜ਼ਤ ਕਰੋ ਹਰ ਕਲਾ ਦੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਹੈ ਸ਼ੁਰ ਤਾਂ ਚੰਗਾ ਚਿੱਤਰਕਾਰ ਦੇ ਲਈ ਅਭਿਆਸ ਰੋਜ਼ ਹੀ ਨਏ ਨਵੀਂ ਚੀਜ਼ ਦਾ ਅਭਿਆਸ ਹੈ ਹੁਣ ਜਿਵੇਂ ਮੈਂ ਤੁਹਾਨੂੰ ਆਪਣੇ ਤਜ਼ਰਬੇ ਦੇ ਨਾਲ ਦੱਸਾਂ ਤਾਂ ਜਦੋਂ ਮੈਂ ਚਿੱਤਰਕਾਰੀ ਸ਼ੁਰੂ ਕਰੀ ਸੀ ਮੈਂ ਚਿੱਤਰਕਾਰੀ ਸ਼ੁਰੂ ਕਰੀ ਸੀਗੀ ਕੁਛ ਆਪਣੀ ਗਿਆਰ੍ਹਵੀਂ ਜਮਾਤ ਵਿੱਚ ਗਿਆਰ੍ਹਵੀਂ ਜਮਾਤ ਮਤਲਬ ਗਿਆਰ੍ਹਵੀਂ ਤੋਂ ਪਹਿਲਾਂ ਵੀ ਮੈਂ ਚਿੱਤਰ ਬਣਾਉਂਦਾ ਸੀ ਪਰ ਓਦੋਂ ਬਹੁਤ ਜਿਵੇਂ ਆਪਾਂ ਪੈਨਸਿਲ ਦੇ ਨਾਲ ਬਸ ਜੋ ਆਪਾਂ ਨੂੰ ਚਿੱਤਰਕਾਰੀ ਦੀ ਕਿਤਾਬ ਹੁੰਦੀ ਹੈ ਉਹ ਤੋਂ ਦੇਖ ਦੇਖ ਕੇ ਚਿੱਤਰ ਲਾਹੇ ਲਾਹਿਆ ਕਰਦਾ ਸੀ ਪਰ ਗਿਆਰ੍ਹਵੀਂ ਦੇ ਵਿੱਚ ਮੈਂ ਐਜ਼ ਅ ਵਿਸ਼ਾ ਇਹਨੂੰ ਲਿਆ ਆਪਣੀ ਜਿਹੜੀ ਮੇਰੀ ਗਿਆਰ੍ਹਵੀਂ ਦੀ ਪੜ੍ਹਾਈ ਸੀ ਉਹਦੇ ਵਿੱਚ ਮੈਂ ਮੇਰਾ ਵਿਸ਼ਾ ਇੱਕ ਸੀਗਾ ਜਿਹਨੂੰ ਅੰਗਰੇਜ਼ੀ ਵਿੱਚ ਫਾਈਨ ਆਰਟਸ ਕਹਿੰਦੇ ਹਨ ਤਾਂ ਉਹਦੇ ਵਿੱਚ ਮੈਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਕਿਉਂਕਿ ਸ਼ੁਰੂਆਤੀ ਪੈਨਸਿਲ ਦੇ ਨਾਲ ਚਿੱਤਰ ਬਣਾਉਣਾ ਬਹੁਤ ਅਸਾਨ ਸੀ ਪਰ ਏਦੂ ਬਾਅਦ 'ਚ ਉਹਦੇ ਵਿੱਚ ਵੱਖ ਵੱਖ ਤਰੀਕੇ ਦੇ ਮਾਧਿਅਮ ਵੀ ਬਹੁਤ ਤਰੀਕੇ ਦੇ ਰੰਗ ਇਸਤੇਮਾਲ ਕਰੇ ਗਏ ਪਾਣੀ ਵਾਲੇ ਰੰਗ ਜੋ ਕਿ ਪਾਣੀ ਦੇ ਨਾਲ ਲੱਗ ਕੇ ਬਣਦੇ ਸਨ ਬਾਕੀ ਪੈਨਸਿਲ ਆ ਜਿਹੜੇ ਰੰਗ ਹੁੰਦੇ ਹਨ ਫੇਰ ਇੱਕ ਮੋਮ ਦੇ ਰੰਗ ਹੁੰਦੇ ਹਨ ਬਹੁਤ ਤਰੀਕੇ ਦੇ ਜਿਹੜੇ ਮਤਲਬ ਮਟੀਰੀਅਲ ਸੀ ਉਹ ਯੂਜ਼ ਕੀਤੇ ਅਤੇ ਉਨ੍ਹਾਂ ਦੇ ਵਿੱਚ ਮਹਾਰਤ ਹਾਸਲ ਕੀਤੀ ਹਰ ਦਿਨ ਅਭਿਆਸ ਨਾਲ ਮੈਂ ਅੱਜ ਵੀ ਦੇਖਦਾ ਹਾਂ ਮੈਂ ਜਿੰਨ ਜਿੰਨੀ ਵਾਰ ਕੋਈ ਵੀ ਨਵਾਂ ਰੰਗ ਚੱਕਦਾ ਹਾਂ ਤਾਂ ਮੈਂ ਉਸ 'ਤੇ ਨਵੀਆਂ ਤਰੰਗਾਂ ਦੇਖਦਾ ਹਾਂ ਕਿ ਵੀ ਉਸਦੇ ਵਿੱਚ ਹੋਰ ਵੀ ਨਵੀਂ ਨਵੀਂ ਕੀ ਹਨ ਤਰੀਕੇ ਹਨ ਉਸ ਨੂੰ ਇਸਤੇਮਾਲ ਕਰਨ ਦੇ ਉਸਨੂੰ ਬਣਾਉਣ ਦੇ ਤਾਂ ਕਦੇ ਵੀ ਜਦੋਂ ਤੁਸੀਂ ਸ਼ੁਰੂਆਤੀ ਤੌਰ 'ਤੇ ਸ਼ੁਰੂ ਕਰੋ ਤਾਂ ਇਹ ਨਹੀਂ ਸੋਚਣਾ ਚਾਹੀਦਾ ਕਿਉਂਕਿ ਇਹ ਬਹੁਤ ਲੋਕ ਗਲਤੀ ਕਰਦੇ ਹਨ ਮੈਨੂੰ ਸ਼ੁਰੂ ਵਿੱਚ ਲੱਗਦਾ ਸੀ ਕਿ ਸ਼ਾਇਦ ਮੈਂ ਪਾਣੀ ਵਾਲੇ ਰੰਗਾਂ ਵਿੱਚ ਕਦੇ ਮਹਾਰਤ ਹਾਸਲ ਨਹੀਂ ਕਰ ਸਕਾਂਗਾ ਪਰ ਅੱਜ ਮੈਂ ਬਹੁਤ ਅਸਾਨੀ ਤਰੀਕੇ ਦੇ ਨਾਲ ਬਹੁਤ ਸੋਹਣੇ ਸੋਹਣੇ ਚਿੱਤਰ ਜੋ ਕਿ ਕੀ ਹੈ ਪੇਸ਼ ਕਰ ਸਕਦਾ ਹਾਂ ਬਹੁਤ ਲੋਗ ਉਨ੍ਹਾਂ ਨੂੰ ਕਹਿੰਦੇ ਹਨ ਕਿ ਇਹੀ ਸਭ ਤੋਂ ਸੋਹਣਾ ਚਿੱਤਰ ਹੈ ਪਰ ਮੈਨੂੰ ਫਿਰ ਵੀ ਉਸਦੇ ਵਿੱਚ ਕੁਛ ਕਮੀਆਂ ਮਿਲਦੀਆਂ ਹਨ ਤਾਂ ਤੁਹਾਡੀਆਂ ਜਿਹੜੀਆਂ ਸ਼ੁਰੂਆਤੀ ਜੋ ਤੁਸੀਂ ਬਣਾਨੇ ਹੋ ਜੋ ਕੰਮ ਕਰਦੇ ਹੋ ਤਾਂ ਉਹ ਤੁਹਾਡਾ ਅਭਿਆਸ ਹੈ ਕਦੇ ਵੀ ਕਦੇ ਅਗਰ ਤੁਹਾਨੂੰ ਲੱਗੇ ਕਿ ਤੁਸੀਂ ਕੋਈ ਚਿੱਤਰ ਸੋਹਣਾ ਨਹੀਂ ਬਣਾਇਆ ਤਾਂ ਉਸ ਤੋਂ ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਮੇਰੀ ਬਹੁਤ ਵੱਡੀ ਗਲਤੀ ਹੈ ਮੈਂ ਇਸ ਨੂੰ ਕਦੇ ਨਹੀਂ ਕਰ ਸਕਦਾ ਵੀ ਇਹ ਮੇਰੇ ਤਰੀਕੇ ਦਾ ਵਿਸ਼ਾ ਹੀ ਨਹੀਂ ਹੈ ਇਸ ਤਰੀਕੇ ਨਾਲ ਤੁਸੀਂ ਆਪਣੀ ਸੋਚ ਨੂੰ ਹਾਰ ਦੇ ਵਿੱਚ ਬਦਲ ਦਿੰਦੇ ਹੋ ਤਾਂ ਕਦੇ ਵੀ ਇਹ ਅਭਿਆਸ ਨਹੀਂ ਛੱਡਣਾ ਚਾਹੀਦਾ ਜਿੰਨਾ ਹੋ ਸਕੇ ਓਨਾਂ ਜ਼ਿਆਦਾ ਤੁਹਾਨੂੰ ਅਭਿਆਸ ਕਰਨਾ ਚਾਹੀਦਾ ਹੈ ਧੰਨਵਾਦ